ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਐਮਾਜ਼ੋਨ ਤੋਂ ਬੋਲ ਰਹੇ ਹੋ ਹਾਂਜੀ ਭਾਅ ਜੀ ਭਾਅ ਜੀ ਮੇਰਾ ਨਾਂ ਨਾ ਜੋਬਨਦੀਪ ਜੀ ਭਾਅ ਜੀ ਮੈਂ ਨਾ ਤੁਹਾਡੇ ਤੋਂ ਨਾ ਪਹਿਲਾਂ ਇੱਕ ਔਰਡਰ ਮੰਗਵਾਇਆ ਸੀ ਸਰ ਐਡੀਦਾਸ ਦਾ ਪੂਰਾ ਫ ਮਤਲਬ ਕਿ ਸੈੱਟ ਮੰਗਵਾਇਆ ਸੀ ਪੂਰੇ ਕੱਪੜਿਆਂ ਦਾ ਇਹ 'ਚ ਜੁਰਾਬਾਂ ਵੀ ਸੀ ਸ਼ੂਜ਼ ਸੀ ਪਜਾਮਾ ਸੀ ਅਤੇ ਟੀ ਸ਼ਰਟ ਸੀ ਉਹਦੇ ਨਾਲ਼ ਗਲਵਸ ਸੀ ਭਾਅ ਜੀ ਉਹ ਐਡੀ ਘੈਂਟ ਚੀਜ਼ ਸੀ ਨਾ ਤੁਸੀਂ ਜਿਹੜੀ ਭੇਜੀ ਭਾਅ ਜੀ ਬਹੁਤ ਵਧੀਆ ਲੱਗਾ ਮੈਨੂੰ ਐਕਸਪੀਰੀਐਂਸ ਭਾਅ ਜੀ ਬਹੁਤ ਵਧੀਆ ਭਾਅ ਜੀ ਉਤੋਂ ਫਿਰ ਮੇਰਾ ਹੈ ਵੀ ਕੈਸ਼ ਓਨ ਡਿਲੀਵਰੀ ਸੀ ਅਤੇ ਤੁਸੀਂ ਮਤਲਬ ਕਿ ਟਾਈਮ ਤੋਂ ਪਹਿਲਾਂ ਹੀ ਭੇਜ ਦਿੱਤਾ ਜੋ ਚੀਜ਼ ਭਾਅ ਜੀ ਬਹੁਤ ਵਧੀਆ ਲੱਗੀ ਭਾਅ ਜੀ ਮੈਂ ਨਾ ਇੱਦਾਂ ਦੇ ਕੱਪੜੇ ਨਾ ਬਾਜ਼ਾਰ 'ਚੋਂ ਵੀ ਲੈ ਕੇ ਆਇਆ ਸੀ ਪਰ ਉਹ ਗੱਲਬਾਤ ਜਿਹੀ ਨਹੀਂ ਬਣੀ ਮਤਲਬ ਕਿ ਐਨੇ ਸਹੀ ਨਹੀਂ ਸੀ ਹੈਗੇ ਐਵੇਂ ਮਤਲਬ ਕਿ ਟਾਈਮ ਪਾਸ ਜਿਹੇ ਹੈਗੇ ਕੱਪੜੇ ਹੈਗੇ ਜਲਦੀ ਫੱਟ ਫੁੱਟ ਗਏ ਸੀ ਪਰ ਭਾਅ ਜੀ ਜਿਹੜੇ ਇਹ ਕੱਪੜੇ ਨਾ ਭਾਅ ਜੀ ਬਹੁਤ ਵਧੀਆ ਭਾਅ ਜੀ ਸਟੱਫ ਇੰਨਾ ਵਧੀਆ ਨਾ ਨਾ ਕੱਪੜਿਆਂ ਦਾ ਰੰਗ ਲੱਥਾ ਜੀ ਅਤੇ ਨਾ ਉਹਨਾਂ ਨੂੰ ਕੁਛ ਹੋਇਆ ਜੀ ਨਹੀਂ ਭਾਅ ਜੀ ਮੈਂ ਤਾਂ ਆਪਣੇ ਮਤਲਬ ਕਿ ਗੁਆਂਢੀਆਂ ਨੂੰ ਵੀ ਕਿਹਾ ਪੰਜ ਛੇ ਜਣਿਆਂ ਨੂੰ ਕਿ ਇਹ ਇੱਥੋਂ ਹੀ ਮੰਗਵਾਉ ਭਾਅ ਜੀ ਬਹੁਤ ਵਧੀਆ ਚੀਜ਼ ਲੱਗੀ ਭਾਅ ਜੀ ਮੈਂ ਨਾਲ਼ੇ ਪੁੱਛਣਾ ਸੀ ਜੇ ਆਪਾਂ ਹੁਣ ਇਹਦੇ ਹੋਰ ਕੋਈ ਨਵਾਂ ਬ੍ਰੈਂਡ ਆਇਆ ਇੱਦਾਂ ਦਾ ਕੋਈ ਵਧੀਆ ਜਿਹੀ ਚੀਜ਼ ਹੋਵੇ ਜਿਹੜੀ ਇੱਦਾਂ ਦੀ ਰਹੇ ਅੱਛਾ ਭਾਅ ਜੀ ਨਹੀਂ ਭਾਅ ਜੀ ਪਰ ਜੋ ਪਹਿਲਾਂ ਵਾਲੀ ਗੱਲ ਸੀ ਨਾ ਭਾਅ ਜੀ ਮੈਨੂੰ ਉਹੀ ਚੀਜ਼ ਚਾਹੀਦੀ ਫੇਰ ਹੀ ਮਜ਼ਾ ਆਊਗਾ ਕੱਪੜੇ ਲੈਣ ਦਾ ਭਾਅ ਜੀ ਬਹੁਤ ਵਧੀਆ ਭਾਅ ਜੀ ਨਾ ਕੱਪੜੇ ਪਾਟੇ ਜਿਹਨੇ ਨਾ ਕੁਛ ਹੋਏ ਜੀ ਉੱਤੋਂ ਮੈਂ ਪਾਉਂਦਾ ਵੀ ਡੇਲੀ ਜੀ ਮੈਂ ਖੇਡਣ ਜਾਣਾ ਹੁੰਦਾ ਵਾ ਅਤੇ ਕੋਈ ਫ਼ਰਕ ਵੀ ਨਹੀਂ ਪਿਆ ਉਹਦੇ ਨਾਲ਼ ਅੱਛਾ ਭਾਅ ਜੀ ਨਹੀਂ ਨਹੀਂ ਭਾਅ ਜੀ ਧੰਨਵਾਦ ਭਾਅ ਜੀ ਬਹੁਤ ਵਧੀਆ ਤੁਹਾ ਤੁਸੀਂ ਚੀਜ਼ ਭੇਜੀ ਆ ਦਿਲ ਖੁਸ਼ ਹੋ ਗਿਆ ਭਾਅ ਜੀ ਜਿਹਨੂੰ ਕਹਿੰਦੇ ਨਾ ਬੰਦੇ ਦੀ ਰੂਹ ਖੁਸ਼ ਹੋ ਜਾਂਦੀ ਉਹ ਹਿਸਾਬ ਸੀ ਭਾਅ ਜੀ ਹਾਂਜੀ ਭਾਅ ਜੀ ਭਾਅ ਜੀ ਮੈਂ ਤਾਂ ਕਹਿੰਦਾ ਕਹਿ ਦਿੱਤਾ ਸੀ ਜਿਹੜਾ ਬੰਦਾ ਲੈ ਕੇ ਗਿਆ ਸੀ ਉਹਨੇ ਵੀ ਅੱਗੋਂ ਬੜਾ ਵਧੀਆ ਡੀਲ ਕੀਤਾ ਉਹਨੂੰ ਵ ਆਪਾਂ ਪਾਣੀ ਪੂਣੀ ਵੀ ਪੁੱਛਿਆ ਉਦੋਂ ਮੈਂ ਕਿਹਾ ਸੀ ਭਾਅ ਜੀ ਟਿੱਪ ਟੁਪ ਚਾਹੀਦੀ ਕਹਿੰਦਾ ਨਹੀਂ ਭਾਅ ਜੀ ਕਹਿੰਦੇ ਹਾ ਸਾਨੂੰ ਕੰਪਨੀ ਬੜਾ ਵਧੀਆ ਸਾਡਾ ਸਾਥ ਦਿੰਦੀ ਸਾਨੂੰ ਲੋੜ ਨਹੀਂ ਪੈਂਦੀ ਟਿੱਪ ਵਗੈਰਾ ਦੀ ਭਾਅ ਜੀ ਇਹ ਸੁਣ ਕੇ ਮੇਰਾ ਦਿਲ ਹੋਰ ਖੁਸ਼ ਹੋ ਗਿਆ ਭਾਅ ਜੀ ਇਹ ਕੰਪਨੀ ਵਧੀਆ ਗੱਲ ਕਰ ਰਹੀ ਹੈ ਵਧੀਆ ਤਰੀਕੇ ਨਾਲ਼ ਡੀਲ ਕਰ ਰਹੀ ਹੈ ਹਾਂਜੀ ਭਾਅ ਜੀ ਨਹੀਂ ਭਾਅ ਜੀ ਆਪਾਂ ਸਾਰਾ ਸਮਾਨ ਇੱਥੋਂ ਹੀ ਮੰਗਵਾਇਆ ਕਰਨਾ ਇਸੇ ਕੰਪਨੀ ਤੋਂ ਅਤੇ ਤੁਹਾਡੇ ਤੋਂ ਹੀ ਮੰਗਵਾਇਆ ਕਰਨਾ ਹਾਂਜੀ ਭਾਅ ਜੀ ਧੰਨਵਾਦ ਭਾਅ ਜੀ ਧੰਨਵਾਦ